ਅਸੀਂ ਆਪਣੇ ਕੈਮਰੇ ਦੇ ਨਾਲ ਵਧੀਆ ਵਧੀਆ ਤਸਵੀਰਾਂ ਖਿੱਚਦੇ ਹਾਂ ਜਿਸ ਤਰ੍ਹਾਂ ਫੁੱਲਾਂ ਦੀਆਂ ਤਸਵੀਰਾਂ ਫੁੱਲਾਂ ਦੀਆਂ ਤਸਵੀਰਾਂ ਖਿੱਚ ਕੇ ਅਸੀਂ ਆਪਣੇ ਮਨ ਨੂੰ ਇੱਕ ਸੰਤੁਸ਼ਟੀ ਦਿੰਦੇ ਹਾਂ ਅਤੇ ਸਾਨੂੰ ਖਿੱਚਣੀਆਂ ਵਧੀਆ ਲੱਗਦੀਆਂ ਹਨ ਅਤੇ ਅਸੀਂ ਕੈਮਰੇ ਦੇ ਨਾਲ ਜਦੋਂ ਵੀ ਕਿਸੇ ਟਰਿੱਪ 'ਤੇ ਜਾਂ ਕਿਸੇ ਵਧੀਆ ਥਾਂ 'ਤੇ ਘੁੰਮਣ ਜਾਈਏ ਅਸੀਂ ਵਧੀਆ ਵਧੀਆ ਪੌਦਿਆਂ ਦੀਆਂ ਵਧੀਆ ਬਿਲਡਿੰਗਾਂ ਦੀਆਂ ਅਤੇ ਜੋ ਵੀ ਚੀਜ਼ ਮਨ ਨੂੰ ਵਧੀਆ ਭਾਉਂਦੀ ਹੈ ਜਿਸ ਤਰ੍ਹਾਂ ਕੋਈ ਫੁੱਲ ਬੂਟਾ ਜਾਂ ਕੋਈ ਵਧੀਆ ਗਰੀਨਰੀ ਜਾਂ ਕੋਈ ਵਧੀਆ ਬਿਲਡਿੰਗ ਜਾਂ ਵਧੀਆ ਸੜਕਾਂ ਅਸੀਂ ਉਸ ਦੀਆਂ ਫੋਟੋਆਂ ਖਿੱਚ ਕੇ ਅਸੀਂ ਸੇਵ ਕਰਦੇ ਹਾਂ ਸਾਨੂੰ ਅਸੀਂ ਫੋਟੋਆਂ ਤਾਂ ਖਿੱਚਦੇ ਹਾਂ ਕਿ ਉਸਦੇ ਵਿੱਚੋਂ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਜੋ ਇੱਕ ਸੰਤੁਸ਼ਟੀ ਹੈ ਫੋਟੋ ਨੂੰ ਅਸੀਂ ਬਾਅਦ ਦੇ ਵਿੱਚ ਵੀ ਦੇਖ ਸਕਦੇ ਹਾਂ ਵੀ ਅਸੀਂ ਉਸ ਥਾਂ 'ਤੇ ਗਏ ਸੀ ਇਹ ਫੋਟੋ ਅਸੀਂ ਉੱਥੋਂ ਖਿੱਚ ਕੇ ਲਿਆਂਦੀ ਸੀ ਅਤੇ ਕੈਮਰਾ ਕੈਮਰੇ ਬਾਰੇ ਤੁਸੀਂ ਆਪ ਜੀਆਂ ਨੇ ਪੁੱਛਿਆ ਹੈ ਅਸੀਂ ਕੈਮਰੇ ਦੇ ਨਾਲ ਵਧੀਆ ਵਧੀਆ ਤਸਵੀਰਾਂ ਖਿੱਚ ਕੇ ਅਤੇ ਵਧੀਆ ਆਪਣਾ ਮਨਪਰਚਾਵਾ ਕਰਦੇ ਹਾਂ ਅਤੇ ਉਸ ਚੀਜ਼ ਨੂੰ ਬਾਅਦ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਅਤੇ ਤਸਵੀਰਾਂ ਹਰੇਕ ਬੰਦੇ ਨੂੰ ਖਿੱਚਣੀਆਂ ਚਾਹੀਦੀਆਂ ਹਨ ਚਾਹੇ ਉਹ ਕਿਸੇ ਫੁਲਵਾੜੀ ਦੀਆਂ ਹੋਣ ਕਿਸੇ ਜਾਨਵਰ ਦੀਆਂ ਹੋਣ ਜਾਂ ਆਪਣੇ ਪੈੱਟ ਦੀਆਂ ਹੋਣ ਜਾਂ ਕਿਸੇ ਵੀ ਵਧੀਆ ਗਰੀਨਰੀ ਦੀਆਂ ਹੋਣ ਤਾਂ ਤਸਵੀਰਾਂ ਅਸੀਂ ਇਸ ਲਈ ਖਿੱਚਦੇ ਹਾਂ ਆਪਣੇ ਮਨ ਦੀ ਸੰਤੁਸ਼ਟੀ ਵਾਸਤੇ